ਮੈਂ ਹਾਲ ਹੀ ਵਿੱਚ ਗਲੋਬਲ ਟਿਕਟ ਰਿਫੰਡ ਲਈ ਆਨਲਾਈਨ ਅਰਜ਼ੀ ਦਿੱਤੀ ਗਈ ਹੈ ਦਿੱਤੀ ਹੈ ਪਰ ਇਸ ਦੀ ਪ੍ਰੋਸੈਸਿੰਗ ਸਥਿਤੀ ਬਾਰੇ ਕੋਈ ਅਪਡੇਟ ਪ੍ਰਾਪਤ ਨਹੀਂ ਹੋਈ ਮੇਰੀ ਅਰਜ਼ੀ ਨੂੰ ਕੁਝ ਸਮਾਂ ਹੋ ਗਿਆ ਅਤੇ ਸੰਚਾਰ ਦੀ ਘਾਟ ਲਗਾਤਾਰ ਨਿਰਾਸ਼ਾਜਨਕ ਹੁੰਦੀ ਆ ਹੁੰਦੀ ਆ ਰਹੀ ਹੈ ਮੈਨੂੰ ਯਕੀਨ ਨਹੀਂ ਹੈ ਵੀ ਪ੍ਰਕਿਰਿਆ ਵਿੱਚ ਕੋਈ ਸਮੱਸਿਆ ਹੈ ਜਾਂ ਮੇਰੀ ਅਰਜ਼ੀ ਵਿੱਚ ਦੇਰੀ ਹੋਈ ਹੈ ਇਸ ਨੂੰ ਹੱਲ ਕਰਨ ਲਈ ਮੈਂ ਆਪਣੇ ਰਿਫੰਡ ਦੀ ਸਥਿਤੀ ਬਾਰੇ ਪੁੱਛਣ ਲਈ ਇਨਕਮ ਟੈਕਸ ਹੈਲਪਲਾਈਨ ਨੂੰ ਕਾਲ ਕਰਨ ਦੀ ਯੋਜਨਾ ਬਣਾ ਰਿਹਾ ਜਦੋਂ ਮੈਂ ਕਾਲ ਕਰਾਂਗਾ ਤਾਂ ਮੈਂ ਇਹ ਯਕੀਨੀ ਬਣਾਵਾਂਗਾ ਕਿ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਮੇਰੀ ਅਰਜ਼ੀ ਦਾ ਹਵਾਲਾ ਨੰਬਰ ਅਤੇ ਹੋਰ ਸੰਬੰਧਿਤ ਵੇਰਵੇ ਮੌਜੂਦ ਹੋਣ ਮੈਂ ਇਹ ਵੀ ਪੁੱਛਾਂਗਾ ਕਿ ਮੈਨੂੰ ਕੋਈ ਵਾਧੂ ਕਦਮ ਚੁੱਕਣ ਦੀ ਲੋੜ ਹੈ ਜਾਂ ਮੇਰੀ ਅਰਜ਼ੀ ਨਾਲ ਕੋਈ ਸਮੱਸਿਆ ਹੈ ਜਿਸ ਨੂੰ ਹੱਲ ਕਰਨ ਦੀ ਲੋੜ ਹੈ ਮੇਰੀ ਵਿੱਤੀ ਯੋਜਨਾਬੰਦੀ ਅਤੇ ਇਹ ਯਕੀਨੀ ਬਣਾਉਣ ਲਈ ਕਿ ਪ੍ਰਸ਼ੰਸਕੀ ਪੱਖ ਤੋਂ ਸਭ ਕੁਝ ਠੀਕ ਠਾਕ ਹੈ ਦੋਵਾਂ ਲਈ ਇਸ ਮਾਮਲੇ 'ਤੇ ਜਿੰਨੀ ਜਲਦੀ ਹੋ ਸਕੇ ਸਪਸ਼ਟਤਾ ਪ੍ਰਾਪਤ ਕਰਨਾ ਮਹੱਤਵਪੂਰਨ ਹੈ ਉਮੀਦ ਹੈ ਇਸ ਕਾਲ ਦੇ ਨਾਲ ਮੈਂ ਇੱਕ ਸਪਸ਼ਟ ਸਮਝ ਪ੍ਰਾਪਤ ਕਰ ਸਕਦਾ ਵਾ ਕਿ ਮੇਰੀ ਰਿਫੰਡ ਨਾਲ ਕੀ ਹੋ ਰਿਹਾ